ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਸਾਡਾ ਭਾਰ ਨਹੀਂ ਵੱਧਦਾ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਸਾਡਾ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ ਸਾਨੂੰ ਡਾਕਟਰ ਕੋਲ ਨਹੀਂ ਜਾਣਾ ਪੈਂਦਾ ਅਸੀਂ ਅਸੀਂ ਹਮੇਸ਼ਾ ਫਿਟ ਰਹਿੰਦੇ ਹਾਂ ਅੱਖਾਂ ਦੀ ਰੋਸ਼ਨੀ ਵਧਦੀ ਹੈ ਗੋਡੇ ਅਤੇ ਮੋਢੇ ਠੀਕ ਰਹਿੰਦੇ ਹਨ